ਆਨਲਾਈਨ ਸਕੂਲਿੰਗ ਅਤੇ ਕੋਚਿੰਗ ਨੇ ਬੱਚਿਆਂ ਨੂੰ ਜੀਵਨ ਨੂੰ ਕਿਵੇਂ ਪ੍ਰਭਾਵਿਤ ਕੀਤਾ ਆਨਲਾਈਨ ਕੋਚਿੰਗ ਇੱਕ ਚੰਗਾ ਵੀ ਹੋ ਸਕਦਾ ਤਾਂ ਜੋ ਬੱਚੇ ਘਰ ਬੈਠ ਕੇ ਪੜ੍ਹ ਸਕਦੇ ਆ ਲਰਨਿੰਗ ਕਰ ਸਕਦੇ ਅਤੇ ਕੋਚਿੰਗ ਵੀ ਕਰ ਸਕਦੇ ਹਨ ਦੂਸਰਾ ਇਸ ਦੇ ਨਾਲ ਬੱਚਿਆਂ ਨੂੰ ਜ਼ਿਆਦਾ ਮੋਬਾਈਲ ਦੀ ਵਰਤੋਂ ਕਰਨ ਲੱਗ ਗਏ ਹਨ ਅਤੇ ਬੱਚਿਆਂ ਨੂੰ ਬਾਹਰ ਅੰਦਰ ਜਾਣ ਦਾ ਮੌਕਾ ਘੱਟ ਮਿਲਿਆ ਅਤੇ ਟੀਚਰਾਂ ਦੀ ਰਿਸਪੈਕਟ ਨਹੀਂ ਹੋ ਰਹੀ ਸੀ ਬੱਚੇ ਘਰੋਂ ਬਾਹਰ ਨਹੀਂ ਜਾ ਰਹੇ ਅਤੇ ਉਹਦੇ ਨਾਲ ਜ਼ਿਆਦਾ ਗੈਜਟ ਯੂਜ ਕਰਦੇ ਨੇ ਭਾਵੇਂ ਬਾਹਰ ਖੇਡਣ ਦਾ ਕੰਮ ਘੱਟ ਗਿਆ ਬੱਚਿਆਂ ਦਾ ਅਤੇ ਔਨਲਾਈਨ ਜ਼ਿਆਦਾ ਹੋਣ ਕਰਕੇ ਮੋਬਾਇਲ ਦੀ ਵਰਤੋਂ ਵੀ ਜ਼ਿਆਦਾ ਵੱਧ ਗਈ ਜਿਸ ਨਾਲ ਬੱਚੇ ਔਨਲਾਈਨ ਕਲਾਸਿਸ ਦੇ ਨਾਲ ਨਾਲ ਗੇਮਜ਼ ਦੇਖਣ ਲੱਗ ਗਏ ਨੇ ਫੋਨਾਂ ਦੀ ਜ਼ਿਆਦਾ ਵਰਤੋਂ ਕਰਨ ਲੱਗ ਗਏ ਜੋ ਕਿ ਸਰੀਰ ਲਈ ਮਾੜਾ ਅਸਰ ਹੋਇਆ ਅਤੇ ਬੱਚਿਆਂ ਦੀ ਆਈਸਾਈਡ ਅੱਖਾਂ 'ਤੇ ਵੀ ਅਸਰ ਹੋਇਆ ਅੱਖਾਂ ਦੀ ਰੌਸ਼ਨੀ 'ਤੇ ਵੀ ਅਸਰ ਹੋਇਆ ਅਤੇ ਬੱਚਿਆਂ ਦੇ ਫੋਨ ਇੱਕ ਲਾਜ਼ਮੀ ਵੀ ਬਣ ਗਿਆ ਤਾਂ ਜੋ ਬੱਚੇ ਇਹਨਾਂ ਦੇ ਨਾਲ ਚਿੜਚਿੜਾਪਨ ਵੀ ਹੋਇਆ ਬੱਚਿਆਂ ਦੇ ਵਿੱਚ